ਹੈਲੋ ਮੈਮ ਸਤਿ ਸ਼੍ਰੀ ਅਕਾਲ ਤੁਸੀਂ ਐਡਵੋਕੇਟ ਜਗਮੀਤ ਕੌਰ ਬੋਲ ਰਹੇ ਓਂ ਨਵਾਂ ਸ਼ਹਿਰ ਡਿਸਟਿਕ ਤੋਂ ਮੈਮ ਮੈਂ ਸਿਮਰਨ ਬੋਲ ਰਹੀ ਆਂ ਐਕਚੁਅਲੀ ਮੈਨੂੰ ਨਾ ਐਡਵੋਕੇਟ ਪੱਲਵੀ ਨੇ ਰੈਫ਼ਰ ਕੀਤਾ ਸੀ ਤੁਹਾਨੂੰ ਕੋਲ ਕਰਨ ਦੇ ਲਈ ਇਹ ਮੈਮ ਐਕਚੁਅਲੀ ਨਾ ਥੋੜ੍ਹਾ ਜਿਹਾ ਮੈਂ ਮੈਂ ਥੋੜ੍ਹੀ ਜਿਹੀ ਮਤਲਬ ਮੈਂਟਲੀ ਅਪਸੈੱਟ ਵੀ ਆਂ ਅਤੇ ਜਿਹੜਾ ਮੇਰਾ ਘਰਵਾਲਾ ਆ ਉਹ ਮੈਨੂੰ ਬਹੁਤ ਕੁੱਟਦਾ ਮਾਰਦਾ ਏਆ ਅਤੇ ਮੈਮ ਮੈਂ ਕੁਝ ਰੈਮੇਡੀ ਜੇ ਹੋ ਸਕੇ ਤਾਂ ਠੀਕ ਹੈ ਮੈਮ ਥੋੜ੍ਹੀ ਜਿਹੀ ਕੰਡੀਸ਼ਨ ਮੇਰੀ ਵੋਸ ਵੋਸ ਕੰਡੀਸ਼ਨ ਹੀ ਆ ਅਤੇ ਮੈਂ ਨਾ ਫ਼ੀਸ ਥੋੜ੍ਹੀ ਜਿਹੀ ਮਤਲਬ ਕਿ ਨਹੀਂ ਪੇਅ ਕਰ ਸਕਦੀ ਮਤਲਬ ਪੈਸੇ ਤਾਂ ਪੇਅ ਕਰਾਂਗੀ ਬਟ ਜੋ ਮੇਰੇ ਤੋਂ ਹੋ ਸਕਿਆ ਉਹ ਮੈਂ ਪੇਅ ਕਰਾਂਗੀ ਤੁਹਾਨੂੰ ਐਕਚੁਅਲੀ ਮੈਮ ਮੈਂ ਸਰਵੈਂਟ ਹਾਂ ਸਾਡੇ ਇੱਥੇ ਨੀਅਰ ਹੈਗਾ ਹਾਊਸ ਮੈਂ ਉੱਥੇ ਜਾਂਦੀ ਹਾਂ ਹਾਂਜੀ ਮੈਮ ਇੱਕ ਮਾੜਾ ਜਿਹਾ ਫੇਵਰ ਕਰ ਦਿਓ ਕਿ ਜਿੰਨਾਂ ਜਲਦੀ ਹੋ ਸਕੇ ਤਾਂ ਹਨਾ ਮਾੜਾ ਜਿਹਾ ਦੇਖ ਲਿਓ ਠੀਕ ਹੈ ਮੈਮ ਮੈਂ ਮਤਲਬ ਕਿ ਰੈਮੇਡੀਜ਼ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਸਕਦੇ ਕੀ ਕੀ ਠੀਕ ਹੈ ਮੈਮ ਫਿਰ ਇੱਕ ਮੇਰਾ ਬੱਚਾ ਵੀ ਹੈ ਛੋਟਾ ਤਿੰਨ ਸਾਲ ਦਾ ਹਾਂਜੀ ਨਹੀਂ ਮੈਮ ਮਤਲਬ ਇੱਦਾਂ ਹੋ ਨਾ ਕਿ ਬੱਚੇ 'ਤੇ ਕੋਈ ਨਾ ਈਮਪੈਕਟ ਪਵੇ ਓਕੇ ਠੀਕ ਆ ਮੈਮ ਥੈਂਕ ਯੂ